ਮੇਰਾ ਨਾਮ ਮੋਨਿਕਾ ਰਾਣੀ ਹੈ ਅੱਜ ਮੈਂ ਤੁਹਾਨੂੰ ਐਮਾਜੋਨ ਬਾਰੇ ਦੱਸਣਾ ਚਾਹੁੰਦੀ ਹਾਂ ਮੈਂ ਆਪਣੀ ਸਹੇਲੀ ਦੇ ਘਰ ਗਈ ਅੱਜ ਅਤੇ ਅਸੀਂ ਬੈਠੇ ਬੈਠੇ ਐਮਾਜੋਨ 'ਤੇ ਸੂਟ ਦੇਖ ਰਹੇ ਸਨ ਅਤੇ ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਅੱਜ ਅਸੀਂ ਐਮਾਜੋਨ 'ਤੇ ਸ਼ੋਪਿੰਗ ਕਰਕੇ ਵੇਖਦੇ ਹਨ ਕੀ ਰਿਜ਼ਲਟ ਆਉਂਦਾ ਹੈ ਉਸਨੇ ਆਪਣੇ ਲਈ ਇੱਕ ਸੂਟ ਔਡਰ ਕੀਤਾ ਅਤੇ ਮੈਂ ਆਪਣੇ ਲੀਏ ਇੱਕ ਫਰਾਕ ਸੂਟ ਔਡਰ ਕੀਤਾ ਸਾਨੂੰ ਤਿੰਨ ਦਿਨਾਂ ਬਾਅਦ ਸਾਡਾ ਔਡਰ ਮਿਲਿਆ ਸਾਨੂੰ ਪ੍ਰਾਪਤ ਹੋਇਆ ਅਤੇ ਸਾਨੂੰ ਕੱਪੜੇ ਇੰਨੇ ਜ਼ਿਆਦਾ ਚੰਗੇ ਲੱਗੇ ਅਸੀਂ ਕੁਝ ਹੋਰ ਵੀ ਮੰਗਵਾਉਣ ਲਈ ਸੋਚਿਆ ਐਮਾਜੋਨ 'ਤੇ ਸਾਨੂੰ ਬਹੁਤ ਹੀ ਸਸਤਾ ਸਮਾਨ ਮਿਲ ਜਾਂਦਾ ਹੈ ਜੋ ਜ਼ਿਆਦਾ ਮਹਿੰਗਾ ਸਮਾਨ ਨਹੀਂ ਖਰੀਦ ਸਕਦੇ ਉਹ ਐਮਾਜੋਨ 'ਤੇ ਸਸਤੇ ਤੋਂ ਸਸਤਾ ਸਮਾਨ ਖਰੀਦ ਸਕਦੇ ਹਨ ਜਿਵੇਂ ਸੂਟ ਸ ਏ ਲਪਿਸਟਿਕ ਵਗੈਰਾ ਅਤੇ ਹੋਰ ਆਦਿ ਸਮਾਨ ਅਤੇ ਅਸੀਂ ਸਾਰਿਆਂ ਨੂੰ ਵੀ ਦੱਸਿਆ ਕਿ ਤੁਸੀਂ ਵੀ ਐਮਾਜੋਨ ਤੋਂ ਸਮਾਨ ਹੀ ਮੰਗਵਾਇਆ ਕਰੋ ਕਿਉਂਕਿ ਉੱਥੇ ਦਾ ਸਮਾਨ ਬਹੁਤ ਹੀ ਜ਼ਿਆਦਾ ਵਧੀਆ ਮਿਲਦਾ ਹੈ